ਹੈਲੋ ਹਾਂਜੀ ਵੀਰੇ ਸਵਿਗੀ ਤੋਂ ਬੋਲਦੇ ਹੋ ਵੀਰੇ ਯਾਰ ਮੈਂ ਤੁਹਾਨੂੰ ਕਦੋਂ ਦਾ ਫੋਨ ਕਰ ਰਿਹਾਂ ਏ ਮੇਰਾ ਔਰਡਰ ਸੀਗਾ ਵੀਰੇ ਦਾਲ ਮੱਖਣੀ ਦਾ ਚਪਾਤੀ ਦਾ ਦੋ ਕੋਲਡ ਡਰਿੰਕ ਸੀਗੀਆਂ ਨਾਲ ਮ ਸ਼ਾਹੀ ਪਨੀਰ ਸੀਗਾ ਯਾਰ ਵੀਰੇ ਅੱਧਾ ਘੰਟਾ ਕਹਿ ਕੇ ਤੁਸੀਂ ਦੋ ਘੰਟੇ ਹੋ ਗਏ ਵੀਰੇ ਮੇਰੇ ਤਾਂ ਰਿਸ਼ਤੇਦਾਰ ਆਏ ਹੋਏ ਸੀਗੇ ਉਹ ਵੀ ਚਲੇ ਗਏ ਮੈਂ ਤੁਹਾਨੂੰ ਫੋਨ ਕਰਿਆ ਤੁਸੀਂ ਫੋਨ ਵੀ ਨਹੀਂ ਚੱਕਿਆ ਤੁਹਾਡਾ ਫੋਨ ਸ਼ੋ ਹੋ ਰਿਹਾ ਸੀਗਾ ਮੈਂ ਜਦੋਂ ਐਪ ਖੋਲ੍ਹੀ ਮੈਂ ਕੀ ਕਰ ਸਕਦਾ ਵੀਰੇ ਮੈਂ ਤਾਂ ਨਾਲ ਦੇ ਢਾਬੇ ਤੋਂ ਫੜ੍ਹ ਕੇ ਲੈ ਕੇ ਆਇਆ ਹੁਣ ਤੁਸੀਂ ਦੇਖੋ ਇਹਦਾ ਕੀ ਕਰਨਾ ਵੀਰੇ ਮੇਰੇ ਤਾਂ ਨਾ ਹੁਣ ਕੋਈ ਕੰਮ ਦਾ ਇਹ ਤੁਸੀਂ ਇਹ ਪੈਸੇ ਕਰੋ ਇਹਨੂੰ ਨਹੀਂ ਮੈਨੂੰ ਦੱਸੋ ਵੀ ਮੈਂ ਸ਼ਿਕਾਇਤ ਪਾਉਂਦਾ ਇਹਦੀ ਮੇਰੇ ਕੋਲ ਜਦੋਂ ਔਰਡਰ ਨਹੀਂ ਆਇਆ ਹੈਗਾ ਤਾਂ ਮੇਰੇ ਪੈਸੇ ਤਾਂ ਰਿਫੰਡ ਹੋਣੇ ਚਾਹੀਦੇ ਨੇ ਵੀਰੇ ਦੇਖੋ ਵੀਰੇ ਤੁਸੀਂ ਮੈਨੂੰ ਦੱਸੋ ਕਿਵੇਂ ਕਰਨਾ ਏ ਅਤੇ ਮੈਂ ਓਕਣਾ ਹੀ ਕਰ ਦੂੰਗਾ ਜਾਂ ਤੁਸੀਂ ਮੇਰੇ ਕੋਲ ਆ ਜੋ ਮੈਨੂੰ ਦੱਸ ਦਉ ਵੀ ਐਕਣ ਐਕਣ ਕਰਨਾ ਮੈਨੂੰ ਪਤਾ ਵੀ ਨਹੀਂ ਹੈਗਾ ਇਹਦੇ ਬਾਰੇ ਵੀ ਕਿਵੇਂ ਕਰਨਾ ਏ ਹਾਂਜੀ ਠੀਕ ਹੈ ਜੀ